ਭਾਰਤ ਸਰਕਾਰ ਨੇ ਲੋਕ ਕਲਿਆਣ ਲਈ ਕਈ ਸਾਰੇ ਸਰਕਾਰੀ ਐਪ ਖੋਲ੍ਹੇ ਹਨ ਜਿਸ ਦੇ ਰਾਹੀਂ ਲੋਕਾਂ ਦੀ ਮਦਦ ਹੋ ਜਾਂਦੀ ਹੈ ਅਤੇ ਉਹਨਾਂ ਦਾ ਕਲਿਆਣ ਹੋ ਜਾਂਦਾ ਹੈ ਜਿਵੇਂ ਕਿ ਯੂ ਟੀ ਐਸ ਆਬਾ ਐਮ ਏ ਡੀ ਏ ਡੀ ਡਿਜਲੋਕਰ ਅਰੋਗਿਆ ਸੇਤੂ ਕ੍ਰਿਸ਼ੀ ਕਿਸਾਨ ਉਮੰਗ ਇੰਡੀਆ ਸੁਵਿਧਾ ਐਪ ਇੱਕ ਸੌ ਬਾਰਾਂ ਇੰਡੀਆ ਈ ਗਰਾਮੀਨ ਸਵਰਾਜ ਕਿਸਾਨ ਸੁਵਿਧਾ ਅਤੇ ਹੋਰ ਵੀ ਕਈ ਸਾਰੇ ਇਸ ਤਰ੍ਹਾਂ ਦੇ ਐਪ ਹਨ ਜੋ ਲੋਕ ਲੋਕਾਂ ਦੀ ਮਦਦ ਕਰਦੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਜਿਵੇਂ ਕਿ ਪਹਿਲਾਂ ਦੋ ਸਾਲ ਪਹਿਲਾਂ ਕਰੋਨਾ ਆਇਆ ਸੀ ਜਿਸ ਵਿੱਚ ਲੋਕ ਘਰਾਂ ਵਿੱਚ ਬੰਦ ਘਰਾਂ ਵਿੱਚ ਆਪਣੇ ਬੰਦ ਹੋ ਗਏ ਸਨ ਉਸ ਦੌਰਾਨ ਵੀ ਸਰਕਾਰ ਨੇ ਕਈ ਐਪ ਸਰਕਾਰੀ ਐਪ ਕੱਢੇ ਸਨ ਜਿ ਜਿਸ ਦੇ ਰਾਹੀਂ ਲੋਕਾਂ ਦੀ ਮਦਦ ਹੋ ਸਕੀ ਹੁਣ ਮੈਂ ਗੱਲ ਕਰਾਂਗੀ ਪੰਜਾਬ ਸਰਕਾਰ ਦੇ ਐਪ ਜੋ ਕਿ ਲੋਕ ਕਲਿਆਣ ਲੋਕ ਹਿੱਤਾਂ ਵਿੱਚ ਹਨ ਅਤੇ ਉਹਨਾਂ ਦੀ ਘਰ ਬੈਠੇ ਹੀ ਮਦਦ ਕਰਦੇ ਹਨ ਜਿਵੇਂ ਕਿ ਕੋਵਾ ਪੰਜਾਬ ਐਮਸੇਵਾ ਪੰਜਾਬ ਜੀ ਗੋ ਪੰਜਾਬ ਕੀਮਤ ਪੰਜਾਬ ਪੰਜਾਬ ਵਾਈਫਾਈ ਵੋਟਰ ਹੈਲਪਲਾਈਨ ਅਨਾਜ ਖ਼ਰੀਦਜ ਪੰਜਾਬ ਪੰਜਾਬ ਕ੍ਰਿਤੀ ਸ ਸਹਾਇਕ ਡੀਜੀਨੀਟ ਪੰਜਾਬ ਐਮਸੇਵਾ ਅਤੇ ਹੋਰ ਵੀ ਕਈ ਸਾਰੇ ਐਪ ਹਨ ਜੋ ਕਿ ਸਰਕਾਰ ਨੇ ਲੋਕਾਂ ਵਾਸਤੇ ਖੋਜੇ ਹਨ ਮੈਂ ਵੀ ਇਹਨਾਂ ਐਪਾਂ ਦੀ ਵਰਤੋਂ ਕਰਦੀ ਹਾਂ ਸਰਕਾਰੀ ਐਪਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਵਿੱਚ ਜਿਵੇਂ ਕਿ ਉਹਨਾਂ ਵਿੱਚੋਂ ਕਈ ਹਨ ਜਿਵੇਂ ਕਿ ਡਿਜੀਲੋਕਰ ਇਸ ਡਿਜੀਲੋਕਰ ਸਰਕਾਰ ਦਾ ਇੱਕ ਬਹੁਤ ਹੀ ਸਹਾਤਿਕ ਸਹਾਇਤਾ ਦੇਣ ਵਾਲਾ ਐਪ ਹੈ ਇਸ ਐਪ ਦੇ ਰਾਹੀਂ ਅਸੀਂ ਘਰ ਬੈਠ ਕੇ ਆਪਣੇ ਕੋਈ ਵੀ ਡਾਕੂਮੈਂਟ ਬਣਵਾ ਸਕਦੇ ਹਨ ਜਿਵੇਂ ਕਿ ਮੈਂ ਜਦੋਂ ਦਸਵੀਂ 'ਚ ਸੀ ਉਂਦੋ ਲੋਕਡਾਊਨ ਸੀ ਤਾਂ ਮੈਨੂੰ ਡੀ ਐਮ ਸੀ ਡਾਊਨਲੋਡ ਕਰਨ ਮੈਨੂੰ ਡਾਈ ਡੀ ਐਮ ਸੀ ਡਾਊਨਲੋਡ ਕਰਨੀ ਸੀ ਉਸ ਲਈ ਮੈਂ ਡੀਜੀਲੋਕਰ ਉਦੋਂ ਮੈਨੂੰ ਡਿਜੀਲਕਰ ਐਪ ਦਾ ਪਤਾ ਲੱਗਿਆ ਤਾਂ ਮੈਂ ਡਿਜੀਲੋਕਰ ਦੇ ਰਾਹੀਂ ਆਪਣੀ ਟੈਂਨਥ ਦੀ ਡੀ ਐਮ ਸੀ ਡਾਊਨਲੋਡ ਕੀਤੀ ਅਤੇ ਫਿਰ ਉਸ ਤੋਂ ਬਾਅਦ ਆਪਣੀ ਪਲੱਸ ਅਤੇ ਹੁਣ ਗ੍ਰੈਜੂਏਸ਼ਨ ਦੀ ਡੀ ਐਮ ਸੀ ਵੀ ਡਿਜੀਲੋਕਰ ਤੋਂ ਹੀ ਡਾਊਨਲੋਡ ਕਰਦੀ ਹਾਂ ਇਸ ਤੋਂ ਇਲਾਵਾ ਸਾਡਾ ਆਧਾਰ ਕਾਰਡ ਵੀ ਡਿਜੀਲੋਕਰ 'ਤੇ ਆ ਜਾਂਦਾ ਹੈ ਅਤੇ ਸਾਡਾ ਲਾਇਸੰਸ ਵੀ ਅਸੀਂ ਡਿਜੀਲੋਕਰ ਤੋਂ ਡਾਊਨਲੋਡ ਕਰ ਸਕਦੇ ਹਾਂ ਇਹ ਸਾਡਾ ਜਿੱਦਾਂ ਇੱਕ ਔਨਲਾਈਨ ਫਾਈਲ ਹੁੰਦੀ ਹੈ ਉਸ ਦੇ ਰਾਹੀਂ ਉਸ ਉਸਦੇ ਪ੍ਰਕਾਰ ਕੰਮ ਆਉਂਦਾ ਹੈ ਇਸ ਨੇ ਸਾਡਾ ਇਸਨੇ ਪੇਪਰ ਦਾ ਕੰਮ ਘੱਟਵਾ ਘੱਟ ਕਰ ਦਿੱਤਾ ਹੈ ਜਿਸ ਨਾਲ ਦਰੱਖਤਾਂ ਦੀ ਰਕਸ਼ਾ ਹੋ ਸਕਦੀ ਹੈ ਅਤੇ ਔਨਲਾਈਨ ਐਪ ਬਹੁਤ ਹੀ ਕੰਮ ਆਉਂਦੇ ਹਨ ਧੰਨਵਾਦ